ਖੇਤ ਜਾਂ ਘਰ ਵਿੱਚ ਜਦੋਂ ਲੋਕ ਕੰਮ ਕਰਦੇ ਹਨ ਤਾਂ ਕਈ ਵਾਰ ਕੰਮ ਕਰਦੇ ਲੋਕ ਅੱਕ ਜਾਂਦੇ ਹਨ ਤਾਂ ਲੋਕ ਕਈ ਤਰ੍ਹਾਂ ਦੇ ਜਿਹੜੇ ਸਾਧਨ ਨੇ ਉਹ ਵਰਤਦੇ ਹਨ ਜਿਵੇਂ ਕਿ ਜਦੋਂ ਕੋਈ ਕਿਸਾਨ ਖੇਤ ਦੇ ਵਿੱਚ ਕੰਮ ਕਰਦਾ ਹੈ ਤਾਂ ਖੇਤਾਂ ਦੇ ਵਿੱਚ ਜਦੋਂ ਉਹ ਟਰੈਕਟਰ 'ਤੇ ਕੰਮ ਕਰ ਰਿਹਾ ਤਾਂ ਟਰੈਕਟਰ 'ਤੇ ਡੈੱਕ ਲੱਗੇ ਹੁੰਦੇ ਹਨ ਜਿਹਨਾਂ ਵਿੱਚ ਉਹ ਗਾਣੇ ਸੁਣਦਾ ਹੈ ਅਤੇ ਗਾਣੇ ਸੁਣਦੇ ਸੁਣਦੇ ਆਪਦਾ ਕੰਮ ਮਨੋਰੰਜਨ ਨਾਲ ਕਰ ਸਕਦਾ ਹੈ ਇਸ ਤਰ੍ਹਾਂ ਘਰ ਦੇ ਵਿੱਚ ਵੀ ਜਿਵੇਂ ਅੱਜ ਕੱਲ੍ਹ ਦੀ ਟੈਕਨੋਲਜੀ ਕਰਕੇ ਹੈੱਡਫੋਨ ਚੱਲਦੇ ਪਏ ਹਨ ਅਤੇ ਜਦੋਂ ਔਰਤਾਂ ਘਰ ਦਾ ਕੰਮ ਕਰਦੀਆਂ ਹਨ ਤਾਂ ਉਹ ਹੈੱਡਫੋਨ ਲਗਾ ਕੇ ਗਾਣੇ ਸੁਣਦੇ ਹੋਏ ਨਾਲ ਨਾਲ ਆਪਦਾ ਕੰਮ ਕਰਦੇ ਹਨ ਪਰ ਜਿਵੇਂ ਪੁਰਾਣੀਆਂ ਔਰਤਾਂ ਹਨ ਉਹ ਜਦੋਂ ਮਿਲ ਕੇ ਕੰਮ ਕਰਦੀਆਂ ਹਨ ਤਾਂ ਉਹ ਜ਼ਿਆਦਾਤਰ ਗੱਲਾਂ ਬਾਤਾਂ ਕਰਦੀਆਂ ਹਨ ਅਤੇ ਗੱਲਾਂ ਬਾਤਾਂ ਕਰਕੇ ਆਪਣਾ ਸਮਾਂ ਗੁਜਾਰਦੇ ਹਨ ਅਤੇ ਹੋਰ ਕੰਮ ਕਰਦਿਆਂ ਕੰਮ ਕਾਰ ਕਰਦਿਆਂ ਹੋਇਆਂ ਜਿਵੇਂ ਖੇਤਾਂ ਦੇ ਵਿੱਚ ਕੰਮ ਕਾਰ ਕਰਦਿਆਂ ਹੋਇਆ ਜਦੋਂ ਦੋ ਜਾਂ ਦੋ ਤੋਂ ਵੱਧ ਜਣੇ ਮਿਲ ਕੇ ਕੰਮ ਕਰਦੇ ਹਨ ਤਾਂ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਹਨ ਗੱਲਾਂ ਕਰਕੇ ਉਹ ਆਪਣਾ ਮਨੋਰੰਜਨ ਕਰਦੇ ਹਨ ਅਤੇ ਕਈ ਵਾਰ ਜਦੋਂ ਲੋਕ ਕੰਮ ਕਰਨ ਤਾਂ ਕੰਮ ਨੂੰ ਇੱਕ ਖੇਡ ਦੀ ਤਰ੍ਹਾਂ ਕਰਦੇ ਹਨ ਜਦੋਂ ਉਹ ਵਾਰੀ ਵਾਰੀ ਨਾਲ ਆਪਦੀਆਂ ਵਾਰੀਆਂ ਬਣਾਉਂਦੇ ਹਨ ਅਤੇ ਉਸ ਤਰ੍ਹਾਂ ਖੇਡਦੇ ਹਨ ਅਤੇ ਜਿਹਦੇ ਨਾਲ ਜਦੋਂ ਉਹ ਕੰਮ ਕਰਦੇ ਹਨ ਨਾਲ ਨਾਲ ਉਹਨਾਂ ਦਾ ਮਨੋਰੰਜਨ ਵੀ ਹੁੰਦਾ ਹੈ ਇਸੇ ਤਰ੍ਹਾਂ ਜਿਹੜੇ ਲੋਕ ਨੇ ਜਾਂ ਫੇਰ ਔਰਤਾਂ ਨੇ ਜਦੋਂ ਉਹ ਕੰਮ ਕਰਦੀਆਂ ਹਨ ਤਾਂ ਉਹ ਗੱਲਾਂ ਬਾਤਾਂ ਕਰਦੀਆਂ ਹਨ ਜਾਂ ਕਿਸੇ ਵੀ ਤਰ੍ਹਾਂ ਨੂੰ ਕੰਮ ਨੂੰ ਇੱਕ ਖੇਡ ਦੇ ਰੂਪ ਦੇ ਵਿੱਚ ਤਬਦੀਲ ਕਰਕੇ ਜਾਂ ਗਾਣੇ ਸੁਣ ਕੇ ਆਪਦਾ ਕੰਮ ਕਰਦੇ ਹਨ